ਅੱਜ ਦੇ ਟਾਈਮ ਦੇ ਵਿੱਚ ਵਿਗਿਆਪਨ ਲੋਕਾਂ ਤੱਕ ਪਹੁੰਚਾਉਣ ਦੇ ਬਹੁਤ ਸਾਰੇ ਤਰੀਕੇ ਹਨ ਕਿਉਂਕਿ ਅੱਜ ਕੱਲ੍ਹ ਲੋਕ ਇੱਕ ਦੂਜੇ ਨਾਲ਼ ਬਹੁਤ ਹੀ ਚੰਗੀ ਤਰ੍ਹਾਂ ਜੁੜੇ ਹੋਏ ਹਨ ਜਿਵੇਂ ਕਿ ਯੂਟਿਊਬ ਐਡਜ਼ ਹੋਗੀਆਂ ਸੋਸ਼ਲ ਸਾਈਟ ਹੋ ਗਏ ਨਿਊਜ਼ਪੇਪਰ ਹੋ ਗਏ ਫਲੈਕਸ ਬੋਰਡ ਹੋ ਗਏ ਫੇਸਬੁੱਕ ਹੋ ਗਿਆ ਅਤੇ ਇੰਸਟਾਗ੍ਰਾਮ ਪੇਜਿਸ ਹੋ ਗਏ ਇਹਨਾਂ ਸਾਰੀਆਂ ਸ਼ੋਸ਼ਲ ਸਾਈਟ ਦੇ ਦੌਰਾਨ ਕਈ ਲੋਕ ਆਪਣੇ ਜਿਹੜੇ ਬਿਜਨਸ ਦੀ ਪ੍ਰਮੋਸ਼ਨ ਹੈ ਜਿਹੜੀ ਕਰਦੇ ਰਹਿੰਦੇ ਹਨ ਯੂਟਿਊਬ ਐਡਜ਼ ਵੀ ਇੱਕ ਇੰਟਰਸਟਿੰਗ ਜਿਹੜਾ ਵਿਗਿਆਪਨ ਦੇਣ ਦਾ ਸਾਧਨ ਹੈ ਕਿਉਂਕਿ ਯੂਟਿਊਬ ਐਡ ਦੇ ਵਿੱਚ ਅਸੀਂ ਅਗਰ ਆਪਾਂ ਫ਼ੋਨ ਨੂੰ ਦੇਖਦੇ ਹਾਂ ਤਾਂ ਅਸੀਂ ਉਸ ਅਗਰ ਐਡ ਕੋਈ ਵੀ ਐਡ ਬਹੁਤ ਵਧੀਆ ਲੱਗਦੀ ਹੈ ਤਾਂ ਆਪਾਂ ਅਸੀਂ ਉਹਨੂੰ ਜ਼ਰੂਰ ਦੇਖਦੇ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਐਡਜ਼ ਮਤਲਬ ਦੇਖੀਆਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਨ ਜਿਵੇਂ ਕਿ ਸਰਫ਼ ਡਿਟਰਜੈਂਟ ਦੀ ਐਡ ਹੋ ਗਈ ਡੀਟੋਲ ਦੀ ਐਡ ਹੋ ਗਈ ਪਰ ਇੱਕ ਐੱਲ ਆਈ ਸੀ ਬੀਮੇ ਦੀ ਜੋ ਐਡ ਹੈ ਉਹ ਮੈਨੂੰ ਬਹੁਤ ਅੱਛੀ ਲੱਗੀ ਐੱਲ ਆਈ ਸੀ ਬੀਮਾ ਜ਼ਿੰਦਗੀ ਕੇ ਸਾਥ ਭੀ ਜ਼ਿੰਦਗੀ ਕੇ ਬਾਦ ਭੀ ਇਸ ਐੱਲ ਆਈ ਸੀ ਬੀਮੇ ਦੇ ਵਿੱਚ ਸਾਨੂੰ ਇਹ ਨੌਲੇਜ਼ ਮਿਲਦੀ ਹੈ ਜਿਵੇਂ ਕਿ ਕੋਈ ਵੀ ਪ੍ਰੋਡਕਟ ਹੈ ਅਸੀਂ ਬਜ਼ਾਰ ਤੋਂ ਖ਼ਰੀਦ ਸਕਦੇ ਹਾਂ ਡੀਟੋਲ ਸਾਬਣ ਹੋ ਗਿਆ ਕੋਈ ਵੀ ਗੌਦਰੇਜ ਕੁਛ ਵੀ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਹੈ ਜਿਹੜਾ ਜਿਹਦੀ ਐਡਵਰਟੀਜ਼ਮੈਂਟ ਆ ਵੀ ਰਹੀ ਹੈ ਨਹੀਂ ਵੀ ਆ ਰਹੀ ਪਰ ਅਸੀਂ ਉਸ ਨੂੰ ਬਜ਼ਾਰ ਤੋਂ ਖ਼ਰੀਦ ਸਕਦੇ ਹਾਂ ਪਰ ਐੱਲ ਆਈ ਸੀ ਇੱਕ ਇੱਦਾਂ ਦੀ ਏਜੰਸੀ ਮਤਲਬ ਤਿਆਰ ਕੀਤੀ ਗਈ ਹੈ ਜਿਸਦੇ ਬਾਰੇ ਲੋਕਾਂ ਨੂੰ ਬਹੁਤ ਜਿਹੜੀ ਘੱਟ ਪਤਾ ਏ ਅਤੇ ਇਸ ਦੀ ਐਡਵਰਟੀਜ਼ਮੈਂਟ ਦੇਣੀ ਜਿਹੜੀ ਬਹੁਤ ਜ਼ਰੂਰੀ ਸੀ ਐਵਰ ਐਡਵਰਟੀਜ਼ਮੈਂਟ ਦੇ ਵਿੱਚ ਸਾਨੂੰ ਜ਼ਿੰਦਗੀ ਦੀ ਪੋਲਿਸੀ ਬਾਰੇ ਦੱਸਦੇ ਆ ਕਿ ਹਾਂ ਕਿਵੇਂ ਅਸੀਂ ਆਪਣੀ ਮਤਲਬ ਡੈੱਥ ਤੋਂ ਬਾਅਦ ਵੀ ਕਲੇਮ ਕਰ ਸਕਦੇ ਹਾਂ ਜਦੋਂ ਕਿਸੇ ਪਰਸਨ ਦੀ ਡੈੱਥ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਇਹ ਚੀਜ਼ ਦਾ ਦੇ ਬਾਰੇ ਪਤਾ ਲੱਗਦਾ ਹੈ ਕਿ ਹਾਂ ਕਿਵੇਂ ਅਸੀਂ ਅਗਰ ਐੱਲ ਆਈ ਸੀ ਬੀਮੇ ਬੀਮਾ ਕਰਵਾਇਆ ਹੁੰਦਾ ਤਾਂ ਅਸੀਂ ਇਸ ਚੀਜ਼ ਬਾਰੇ ਜ਼ਰੂਰ ਹੈ ਜਿਹੜਾ ਇਸ ਦਾ ਕਲੇਮ ਲੈ ਸਕਦੇ ਹਾਂ ਇਸ ਕਰਕੇ ਐੱਲ ਆਈ ਸੀ ਬੀਮੇ ਦੀ ਜੋ ਐਡ ਹੈ ਉਹ ਮੈਨੂੰ ਸਭ ਤੋਂ ਵੱਧ ਵਧੀਆ ਲੱਗੀ ਜ਼ਿੰਦਗੀ ਕੇ ਸਾਥ ਭੀ ਜ਼ਿੰਦਗੀ ਕੇ ਬਾਦ ਭੀ